ਸਤਿ ਸ਼੍ਰੀ ਅਕਾਲ ਜੀ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ ਜੇ ਅਸੀਂ ਕਿਸੇ ਵੀ ਸਮਾਜ ਵਿੱਚ ਰਹਿਣਾ ਹੈਗਾ ਹੈ ਜੇਕਰ ਸਮਾਜ ਦੇ ਵਿੱਚ ਕੋਈ ਕਾਨੂੰਨ ਹੀ ਨਾ ਹੋਊਗਾ ਤਾਂ ਅਸੀਂ ਉਸ ਵਿੱਚ ਕਿੱਦਾਂ ਰਹਿ ਸਕਦੇ ਹਾਂ ਤਾਂ ਉਸ ਜਿੱਦਾਂ ਕਿ ਜਾਨਵਰ ਰਹਿ ਰਹੇ ਆ ਫਿਰ ਅਸੀਂ ਵੀ ਉਸ ਤਰ੍ਹਾਂ ਹੀ ਰਹਾਂਗੇ ਇਸ ਲਈ ਜੇ ਅਸੀਂ ਹਿਊਮਨਸ ਵਾਂਗ ਮਨੁੱਖਾ ਵਾਂਗ ਆਪਣੇ ਸਮਾਜ ਦੇ ਵਿੱਚ ਰਹਿਣਾ ਹੈਗਾ ਤਾਂ ਉਸ ਦੇ ਲਈ ਸਾਨੂੰ ਕਾਨੂੰਨ ਦੇ ਨਿਯਮਾਂ ਦੀ ਪਾਲਣਾ ਕਰਨੀ ਪਏਗੀ ਅਤੇ ਕਾਨੂੰਨ ਦੇ ਨਿਯਮ ਹੀ ਜੇਕਰ ਗਲਤ ਹੋਣਗੇ ਤਾਂ ਸਮਾਜ ਵਿੱਚ ਸ਼ਾਂਤੀ ਕਿਵੇਂ ਰਹਿ ਸਕਦੀ ਹੈ ਇਸ ਕਰਕੇ ਸਾਨੂੰ ਕਾਨੂੰਨ ਦੇ ਨਿਯਮਾਂ ਨੂੰ ਮਤਲਬ ਕਿ ਵਧੀਆ ਬਣਾਉਣਾ ਚਾਹੁੰਦਾ ਚਾਹੀਦਾ ਹੈਗੇ ਸਿਰਫ ਕਾਨੂੰਨ ਦੀ ਨਿਯਮ ਬਣਾ ਕੇ ਹੀ ਸਿਰਫ ਉਸਨੂੰ ਉੱਥੇ ਤੱਕ ਹੀ ਨਹੀਂ ਛੱਡ ਦੇਣਾ ਚਾਹੀਦਾ ਸਮਾ ਕਿ ਸਾਨੂੰ ਉਸ ਜੋ ਵੀ ਜੋ ਵੀ ਕਾਨੂੰਨ ਬਣਾਏ ਗਏ ਹਨ ਉਹਨਾਂ ਦੀ ਪਾਲਣਾ ਕਰਨੀ ਚਾਹੀਦੀ ਹੈਗੀ ਹੈ ਜਿਹੜਾ ਪਾਲਣਾ ਨਹੀਂ ਕਰਦਾ ਹੈਗਾ ਉਹਨਾਂ ਦੇ ਖਿਲਾਫ ਵੀ ਸਖ਼ਤ ਤੋਂ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈਗੀ ਆ ਜਿਵੇਂ ਕਿ ਅਸੀਂ ਦੇਖਦੇ ਹੈ ਕਿ ਸਮਾਜ ਦੇ ਵਿੱਚ ਬਹੁਤ ਤਰ੍ਹਾਂ ਦਾ ਅੱਤਿਆਚਾਰ ਹੋ ਰਿਹਾ ਹੈਗਾ ਆ ਜਿਵੇਂ ਕਿ ਜਿਹੜੇ ਆਪਣੇ ਤੋਂ ਵੱਡੇ ਮ ਹਿਊਮਨਸ ਹੈਗੇ ਆ ਅਤੇ ਉਹਨਾਂ ਦੇ ਕੋਲ ਜੇਕਰ ਜ਼ਿਆਦਾ ਪੈਸਾ ਹੈਗਾ ਐਗਾ ਤਾ ਉਹ ਉਹਨਾਂ ਤੋਂ ਘੱਟ ਪੈਸੇ ਵਾਲੇ ਮਨੁੱਖ ਨੂੰ ਸਾ ਸਮਾਜ ਦੇ ਵਿੱਚ ਰਹਿਣ ਦੇ ਕਾਬਿਲ ਨਹੀਂ ਸਮਝਦੇ ਹੈਗੇ ਅਤੇ ਉਹਨਾਂ 'ਤੇ ਅੱਤਿਆਚਾਰ ਕਰਦੇ ਹੈਗੇ ਆ ਅਤੇ ਸਮਾਜ ਦੇ ਵਿੱਚ ਹੋਰ ਵੀ ਬਹੁਤ ਸਾਰੇ ਇੱਦਾਂ ਦੇ ਅੱਤਿਆਚਾਰ ਕਰ ਹੋ ਰਹੇ ਹੈਗੇ ਆ ਜਿਸ ਕਰਕੇ ਸਮਾਜ ਦੇ ਵਿੱਚ ਰਹਿਣਾ ਬਹੁਤ ਹੀ ਮੁਸ਼ਕਿਲ ਹੋ ਗਿਆ ਹੈ ਇਸ ਕਰਕੇ ਜੇ ਅਸੀਂ ਸਮਾਜ ਦੇ ਵਿੱਚ ਰਹਿਣਾ ਚਾਹੁੰਦੇ ਹੈਗੇ ਹਾਂ ਤਾਂ ਸਾਨੂੰ ਕਾਨੂੰਨ ਦੁਆਰਾ ਬਣਾਏ ਗਏ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈਗੀ ਹੈ ਜੇਕਰ ਅਸੀਂ ਕਾਨੂੰਨ ਦੁਆਰਾ ਨਿਯਮਾਂ ਦੀ ਪਾਲਣਾ ਕਰਾਂਗੇ ਤਾਂ ਅਸੀਂ ਸਮਾਜ ਦੇ ਵਿੱਚ ਚੰਗੇ ਢੰਗ ਦੇ ਨਾਲ ਰਹਿ ਸਕਾਂਗੇ ਅਤੇ ਸ਼ਾਂਤੀ ਬਣਾਈ ਰੱਖਾਂਗੇ ਧੰਨਵਾਦ